ਜੀ ਹਾਂ ਸਰਕਾਰ ਸਾਡੇ ਭਾਈਚਾਰੇ ਬਹੁਤ ਕੁਛ ਕਰ ਰਹੀਆਂ ਹਨ ਪਰ ਮੈਂ ਆਪਣੇ ਸਕੂਲ ਤੋਂ ਹੀ ਬਹੁਤ ਕੁਛ ਪੜ੍ਹਿਆ ਹੈ ਇਸ ਬਿਮਾਰੀਆਂ ਬਾਰੇ ਜਿਵੇਂ ਕਿ ਟੀ ਬੀ ਦੀ ਬਿਮਾਰੀ ਹੋ ਗਈ ਕੈਂਸਰ ਦੀ ਬਿਮਾਰੀ ਹੋ ਗਈ ਜੋ ਕਿ ਮੈਂ ਆਪਣੇ ਪ੍ਰਾਈਮਰੀ ਸਕੂਲਿੰਗ ਵਿੱਚ ਹੀ ਪੜ੍ਹਿਆ ਹੈ ਅਤੇ ਜਦੋਂ ਮੈਂ ਸੀਨੀਅਰ ਸੈਕੈਂਡਰੀ ਵਿੱਚ ਗਿਆ ਤਾਂ ਮੈਨੂੰ ਹੋਰ ਵੀ ਜੋ ਕਿ ਬਹੁਤ ਹੀ ਮਾਰੂ ਬਿਮਾਰੀਆਂ ਹਨ ਉਹਨਾਂ ਬਾਰੇ ਪੜ੍ਹਿਆ ਹੈ ਸਰਕਾਰ ਸਾਡੇ ਲਈ ਬਹੁਤ ਕੁਛ ਕਰ ਰਹੀ ਹੈ ਸਾਡੇ ਲਈ ਕੈਂਪ ਲਗਾ ਰਹੀ ਹੈ ਤਾਂ ਜੋ ਸਾਨੂੰ ਇਹਨਾਂ ਬਿਮਾਰੀਆਂ ਬਾਰੇ ਪਤਾ ਲੱਗੇ ਅਤੇ ਸਰਕਾਰੀ ਹਸਪਤਾਲਾਂ ਵਿੱਚ ਸਾਨੂੰ ਮੁਫ਼ਤ ਦਵਾਈ ਮਿਲਦੀ ਹੈ ਜਿਵੇਂ ਕਿ ਟੀ ਬੀ ਦੀ ਮੁਫ਼ਤ ਦਵਾਈ ਮਿਲਦੀ ਹੈ ਅਤੇ ਬਹੁਤ ਸਾਰੇ ਮਰੀਜ਼ ਇਹਨਾਂ ਦਵਾਈਆਂ ਨਾਲ ਖਾ ਕੇ ਆਪਣੇ ਆਪ ਨੂੰ ਸੁਰੱਕਸ਼ਿਤ ਮਹਿਸੂਸ ਕਰ ਰਹੇ ਹਨ ਸੋ ਸਰਕਾਰਾਂ ਬਹੁਤ ਹੀ ਮਦਦਗਾਰ ਹਨ ਸਾਡੇ ਲਈ